ਵੈਸੇ ਤਾਂ ਅਗਰ ਗੱਲ ਕੀਤੀ ਜਾਵੇ ਮੌਸਮ ਵਿੱਚ ਤੁਸੀਂ ਕਿਸ ਟਾਈਮ ਮਤਲਬ ਘੁੰਮਣਾ ਪਸੰਦ ਕਰਦੇ ਹੋ ਮੈਂ ਜ਼ਿਆਦਾਤਰ ਗਰਮੀਆਂ ਦੇ ਵਿੱਚ ਘੁੰਮਣਾ ਪਸੰਦ ਕਰਦਾ ਏ ਹਾਂ ਕਿਉਂਕਿ ਗਰਮੀ ਇੱਕ ਇਹੋ ਜਿਹੀ ਚੀਜ਼ ਹੈ ਜਿਸ ਦੇ ਵਿੱਚ ਇਨਸਾਨ ਨੂੰ ਕਿਸੇ ਵੀ ਮਤਲਬ ਗਰਮੀ ਦੇ ਵਿੱਚ ਘੁੰਮਣਾ ਇਨਸਾਨ ਆਪਣੇ ਫੈਮਲੀ ਦੇ ਨਾਲ ਕਿਸੇ ਵੀ ਪਾਸੇ ਜਾ ਸਕਦਾ ਹੈ ਕਿਉਂਕਿ ਗਰਮੀ ਹੁੰਦੀ ਹੈ ਬੰਦਾ ਜ਼ਿਆਦਾਤਰ ਠੰਡੇ ਮੌਸਮ ਵੱਲ ਜ਼ਿਆਦਾ ਭੱਜਦਾ ਏ ਆ ਮੈਂ ਜ਼ਿਆਦਾਤਰ ਮਨਾਲੀ ਜਾਂ ਸ਼ਿਮਲਾ ਸਾਈਡ ਜਾਂ ਕਸੌਲੀ ਸਾਈਡ ਘੁੰਮਣਾ ਜ਼ਿਆਦਾ ਪਸੰਦ ਕਰਦਾ ਹਾਂ ਜਦੋਂ ਉੱਧਰਲੀ ਸਾਈਡ ਠੰਡਾ ਮੌਸਮ ਹੁੰਦਾ ਆਪਣੀ ਫੈਮਲੀ ਦੇ ਨਾਲ਼ ਉੱਧਰਲੀ ਸਾਈਡ ਟਰੈਵਲ ਕਰਦਾ ਹਾਂ